ਸਾਡੇ ਆਪਣੇ ਵਿਚਾਰਾਂ ਵਿੱਚ ਨਿਖਾਰ ਉਦੋਂ ਹੀ ਆਉਂਦਾ ਹੈ ਜਦੋਂ ਆਪਾਂ ਕਿਸੇ ਕਲਾ ਦੇ ਵਿੱਚ ਮਾਹਰ ਹੁੰਦੇ ਹਾਂ ਜਾਂ ਕਲਾ ਨੂੰ ਅਸੀਂ ਆਪਣੇ ਜੀਵਨ ਵਿੱਚ ਉਤਾਰਦੇ ਹਾਂ ਜਿੱਦਾਂ ਕਿ ਆਪਾਂ ਦੇਖਦੇ ਹਾਂ ਹਰ ਇੱਕ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸ਼ੌਕ ਹੁੰਦਾ ਹੈ ਉਵੇਂ ਹੀ ਮੈਨੂੰ ਕਲਾ ਦੇ ਵਿੱਚ ਡਰਾਇੰਗ ਦਾ ਸ਼ੌਕ ਸੀ ਸ਼ੌਕ ਹੈ ਅਤੇ ਕਦੇ ਕਦਾਈਂ ਜਿੱਦਾਂ ਮੈਨੂੰ ਲੱਗਦਾ ਕਿ ਕਿਸੇ ਜੇ ਮੇਰਾ ਮੂਡ ਆ ਜਿਹੜਾ ਜਿਹੜਾ ਮੇਰਾ ਮਨ ਹੈ ਦੁਖੀ ਹੋਵੇ ਜਾਂ ਮੇਰਾ ਮਨ ਖੁਸ਼ ਹੋਵੇ ਜਾਂ ਮੈਨੂੰ ਕੁਛ ਕਰਨ ਨੂੰ ਮੈਂ ਵਿਹਲਾ ਹੋਵਾਂ ਜਾਂ ਮਤਲਬ ਕਿਸੇ ਵੀ ਮੂਡ ਜਦੋਂ ਮੇਰਾ ਮਨ ਕਿਸੇ ਅਡੋਲ ਸਥਿਤੀ ਦੇ ਵਿੱਚ ਹੋਵੇ ਤਾਂ ਉਸ ਟਾਈਮ ਮੇਰਾ ਮਨ ਕਰਦਾ ਕਿ ਹਾਂ ਕੁਛ ਡਰੋਇੰਗ ਬਣਾਈ ਜਾਵੇ ਕਿਸੇ ਦੀ ਕਲਾਕਾਰੀ ਕੀਤੀ ਜਾਵੇ ਕਿਸੇ ਦਾ ਚਿੱਤਰ ਹੈ ਜਿਹੜਾ ਆਪਣੀ ਕਿਤਾਬ ਉੱਤੇ ਉਤਾਰਿਆ ਜਾਵੇ ਜਿੱਦਾਂ ਕਿ ਫੁੱਲਾਂ ਦਾ ਜਿੱਦਾਂ ਕਿ ਪਕਸ਼ ਪਸ਼ੂ ਪੰਛੀਆਂ ਦਾ ਜਿੱਦਾਂ ਕਿ ਕਿਸੇ ਕੁਦਰਤੀ ਚੀਜ਼ ਦਾ ਜਿਹੜਾ ਡਰਾਇੰਗ ਆ ਉਹ ਬਣਾਉਣ ਦੇ ਵਿੱਚ ਮੈਨੂੰ ਤਾਂ ਬਹੁਤ ਹੀ ਸਹੀ ਲੱਗਦਾ ਅਤੇ ਮੈਂ ਉਸਨੂੰ ਬਣਾ ਕੇ ਆਪਣੀ ਡਰੋਇੰਗ ਦੇ ਵਿੱਚ ਬੜਾ ਹੀ ਸ਼ਾਂਤ ਮਹਿਸੂਸ ਕਰਦਾ ਹਾਂ ਮਤਲਬ ਕਿ ਜਿਹੜੀ ਵੀ ਚੀਜ਼ ਮੈਂ ਬਣਾਉਂਦਾ ਉਹ ਮੇਰੇ ਮਨ ਨੂੰ ਮਨ ਦੇ ਅੰਦਰ ਸ਼ਾਂਤੀ ਭਰਦੀ ਹੈ ਜਿਹਦੇ ਨਾਲ ਮੇਰਾ ਜਿਹੜਾ ਆਂਤ੍ਰਿਕ ਆ ਤੜਫਦੀ ਆਤਮਾ ਹੈ ਉਹਨੂੰ ਇੱਕ ਪਾਣੀ ਦੀ ਪਿਆਸ ਜਿੱਦਾਂ ਲੱਗੀ ਹੁੰਦੀ ਹੈ ਉਹ ਮੇਰੀ ਕਲਾਕਾਰੀ ਮੇਰੀ ਡਰੋਇੰਗ ਬੁਝਾਉਂਦੀ ਹੈ